ਮੇਰਾ ਨਾਮ ਅਰਵਿੰਦ ਹੈਗਾ ਅਤੇ ਮੈਂ ਪਠਾਨਕੋਟ ਦਾ ਰਹਿਣ ਵਾਲਾ ਹਾਂ ਜੇ ਕਰਾਂ ਮੈਂ ਮੈਰਾਥਨ ਮੈਰਾਥਨ ਦੌੜ ਦੀ ਗੱਲ ਕਰਾਂ ਤਾਂ ਮੈਂ ਮੈਰਾਥਨ ਦੋ ਜਾਂ ਤਿੰਨ ਵਾਰੀ ਮੈਂ ਮੈਥਾ ਮੈਰਾਥਨ ਵਿੱਚ ਦੌੜੇ ਦਾ ਹੈਗਾਂ ਅਤੇ ਓਹਦੇ ਵਿੱਚ ਮੈਂ ਦੂਜਾ ਸਥਾਨ ਹਾਸਲ ਕੀਤੇ ਦਾ ਹੈਗਾ ਅਤੇ ਜੇ ਮੈਂ ਇਹ ਗੱਲ ਕਰਾਂ ਕਿ ਮੈਂ ਮਿਹਨਤ ਬਾਰੇ ਜਾਂ ਕਿੱਦਾਂ ਤਿਆਰੀ ਕੀਤੀ ਜਾਂ ਮੇਰਾ ਅਨੁਭਵ ਕੀ ਹੈ ਮੇਰਾ ਅਨੁਭਵ ਇਹ ਹੈ ਕਿ ਮੈਂ ਰੋਜ਼ ਸਵੇਰੇ ਮੇਰਾ ਮੈਂ ਅਤੇ ਮੇਰਾ ਮੇਰਾ ਭਰਾ ਅਤੇ ਮੇਰੇ ਕੁਝ ਦੋਸਤ ਹੈਗੇ ਸੀ ਜੋ ਜਿਨ੍ਹਾਂ ਨੂੰ ਕਿ ਦੋੜਨ ਦਾ ਬਹੁਤ ਸ਼ੌਂਕ ਸੀਗਾ ਅਤੇ ਰੋਜ਼ ਅਸੀਂ ਸਵੇਰੇ ਛੇ ਵਜੇ ਉੱਠ ਉੱਠ ਕੇ ਅਸੀਂ ਇੱਕ ਜਗ੍ਹਾ 'ਤੇ ਖੜ੍ਹ ਇੱਕ ਜਗ੍ਹਾ 'ਤੇ ਜਾ ਕੇ ਪਹਿਲੇ ਵਾਰਮ ਅੱਪ ਕਰਦੇ ਸੀ ਐਕਸਰਸਾਈਜ ਕਰਦੇ ਸੀ ਥੋੜ੍ਹੀ ਜਿਹੜੀ ਅੱਧਾ ਘੰਟਾ ਜਾਂ ਦੋ ਡੇਢ ਘੰਟਾ ਉਹਦੇ ਤੋਂ ਬਾਅਦ ਅਸੀਂ ਦੋ ਪੰਜ ਕਿਲੋ ਪੰਜ ਪੰਦਰ੍ਹਾਂ ਵੀਹ ਕਿਲੋਮੀਟਰ ਦੀ ਜਿਹੜੀ ਅਸੀਂ ਲੰਬੀ ਦੌੜ ਲਗਾਉਂਦੇ ਸੀ ਲੰਬੀ ਦੌੜ ਲਾਉਣ ਤੋਂ ਬਾਅਦ ਅਸੀਂ ਫਿਰ ਇੱਕ ਜਗ੍ਹਾ ਰੁੱਕ ਕੇ ਐਕਸਰਸਾਈਜ ਕਰਦੇ ਸੀ ਫੇਰ ਅਸੀਂ ਅੱਧਾ ਘੰਟਾ ਪੰਦਰ੍ਹਾਂ ਵੀਹ ਮਿੰਟ ਐਕਸਰਸਾਈਜ ਕਰਦੇ ਸੀ ਐਕਸਰਸਾਈਜ ਕਰਨ ਤੋਂ ਬਾਅਦ ਅਸੀਂ ਘਰ ਆ ਜਾਂਦੇ ਸੀ ਘਰ ਆਉਣ ਤੋਂ ਬਾਅਦ ਫੇਰ ਜਿਹੜਾ ਟਾਇਮ ਕੁਛ ਕੰਮ ਕੁਮ ਕਰਕੇ ਫਿਰ ਅਸੀਂ ਸ਼ਾਮੀ ਪੰਜ ਵਜੇ ਫਿਰ ਅਸੀਂ ਦੌੜ ਲਾਉਣ ਚਲੇ ਜਾਂਦੇ ਸੀ ਦੌੜ ਲਾ ਕੇ ਓਹੀ ਸਵੇਰੇ ਓਹੀ ਸਵੇਰੇ ਦੌੜ ਲਾਉਣੀ